ਹਾਂਜੀ ਬਿਲਕੁਲ ਬਿਲਕੁਲ ਸਟੈਪ ਬਹੁਤ ਨੇ ਭੰਗੜੇ ਦੇ ਜਿਵੇਂ ਕਿ ਮੰਨ ਲਉ ਧਮਾਲ ਹੋ ਗਈ ਝੂਮਰ ਹੋ ਗਿਆ ਤਾੜੀ ਝੂਮਰ ਹੋ ਗਿਆ ਫੁੰਮਣੀਆਂ ਹਾਥੀ ਚਾਲ ਲਾਹੌਰੀਏ ਸੰਮੀ ਸੱਜ ਖੁੱਲਾ ਭੰਗੜਾ ਇਦਾਂ ਹੋਰ ਵੀ ਬਹੁਤ ਸਾਰੇ ਸਟੈਪ ਨੇ ਭੰਗੜੇ ਦੇ ਜੋ ਕਿ ਸਟੇਜਾਂ 'ਤੇ ਵੀ ਪਾਏ ਜਾਂਦੇ ਨੇ ਵਿਆਹ ਸ਼ਾਦੀਆਂ 'ਚ ਪਾਏ ਜਾਂਦੇ ਨੇ ਭੰਗੜੇ ਦਾ ਮੰਨ ਲਉ ਜਿਵੇਂ ਹੁਣ ਵਿਸਾਖੀ ਆਉਂਦੀ ਹੈ ਤਾਂ ਉੱਥੇ ਭੰਗੜਾ ਪਾਇਆ ਜਾਂਦਾ ਲੋਕਾਂ ਦੇ ਵਿੱਚ ਮਨ 'ਚ ਚਾਅ ਹੁੰਦਾ ਵੀ ਵਿਸਾਖੀ ਆਈ ਅਤੇ ਭੰਗੜਾ ਪਾਈਏ ਹੋਰ ਵੀ ਬਹੁਤ ਮੰਨ ਲਉ ਜਾਗੋ 'ਤੇ ਵੀ ਭੰਗੜਾ ਪਾਉਂਦੇ ਨੇ ਅਤੇ ਹੋਰ ਕਾਫ਼ੀ ਥਾਂ 'ਤੇ ਪਾਏ ਨੇ ਅੱਜ ਕੱਲ੍ਹ ਕਾਲਜਾਂ 'ਚ ਵਿੱਚ ਵੀ ਭੰਗੜੇ ਨੂੰ ਤਰਜੀਹ ਦਿੱਤੀ ਜਾਂਦੀ ਹੈ ਭੰਗੜਾ ਪਵਾਇਆ ਜਾਂਦਾ ਗਾ ਤਾਂ ਕਿ ਖੁਸ਼ੀ ਦੇ ਖ਼ਾਸ ਕਰ ਖੁਸ਼ੀ ਮੌਕਿਆਂ 'ਤੇ ਵੱਧ ਤੋਂ ਵੱਧ ਭੰਗੜਾ ਪਾਇਆ ਜਾਂਦਾ ਗਾ ਅੱਜ ਕੱਲ੍ਹ ਤਾਂ ਦੇਖਿਆ ਜਾਂਦਾ ਜਿਵੇਂ ਕਿ ਕੋਈ ਮੰਨ ਲਉ ਕਿਸੇ ਨੇ ਕੋਈ ਛੋਟਾ ਜਿਹਾ ਵੀ ਪ੍ਰੋਗਰਾਮ ਕਰਿਆ ਤਾਂ ਉੱਥੇ ਵੀ ਭੰਗੜਾ ਪਵਾਇਆ ਜਾਂਦਾ ਭੰਗੜੇ ਵਾਲਿਆਂ ਨੂੰ ਬੁਲਾਇਆ ਜਾਂਦਾ ਉਹਨਾਂ ਤੋਂ ਸਟੈਪ ਕਰਵਾਏ ਸਭ ਤੋਂ ਜ਼ਿਆਦਾ ਤਾਂ ਝੂਮਰ ਅਤੇ ਧਮਾਲ ਪਵਾਈ ਜਾਂਦੀ ਹੈ ਭੰਗੜੇ 'ਚ ਤਾਂ ਕਿ ਉਹ ਉਹਨਾਂ ਨੂੰ ਬਸ ਉਹ ਜਿਹੜੇ ਹੁੰਦੇ ਨੇ ਨਾ ਦੇਖਣ ਵਾਲੇ ਉਹ ਦੇਖਦੇ ਹੀ ਰਹਿ ਜਾਂਦੇ ਨੇ ਭੰਗੜੇ ਇੱਕ ਐਸੀ ਜੋਸ਼ ਹੈ ਨਾ ਭੰਗੜੇ 'ਚ ਕੀ ਲੋਕ ਹਟ ਨਹੀਂ ਸਕਦੇ ਵੀ ਦੇਖਣੋ ਵੀ ਨਾ ਰਹਿ ਸਕਦੇ ਫਿਰ ਉਹ ਖੁਦ ਵੀ ਸੋਚਦੇ ਨੇ ਵੀ ਅਸੀਂ ਵੀ ਭੰਗੜਾ ਪਾਈਏ ਭੰਗੜੇ ਨਾਲ ਆਪਾਂ ਨੂੰ ਕਿਉਂਕਿ ਆਪਾਂ ਨੂੰ ਬਹੁਤ ਸਾਰੇ ਬੈਨੀਫਿਟ ਵੀ ਮਿਲਦੇ ਇਹਦੇ ਨਾ ਆਪਣੇ ਸਰੀਰ ਜਿਹੜਾ ਤੰਦਰੁਸਤ ਰਹਿੰਦਾ ਗਾ ਇਹਦੇ ਵਿੱਚ ਨਾਲ ਆਪਣਾ ਸਰੀਰ 'ਚ ਕਾਫੀ ਸਾਰੇ ਬੈਨੀਫਿਟਸ ਆ ਮਤਲਬ ਕਸਰਤ ਹੁੰਦੀ ਆ ਅਤੇ ਆਪਣਾ ਸਰੀਰ ਸਹੀ ਰਹਿੰਦਾ ਹੈ ਅੱਜ ਕੱਲ੍ਹ ਤਾਂ ਛੋਟੇ ਛੋਟੇ ਬੱਚਿਆਂ ਨੂੰ ਵੀ ਭੰਗੜਾ ਸਿਖਾਇਆ ਜਾਂਦਾ ਹੈਗਾ ਤਾਂ ਕਿ ਉਹ ਆਪਣਾ ਜਿਹੜਾ ਇਹ ਭੰਗੜਾ ਨਾ ਇੱਕ ਲੋਕ ਨਾਚ ਆ ਇਹਨੂੰ ਹੋਰ ਅੱਗੇ ਵ ਦੀ ਅਤੇ ਆ ਅੱਜ ਕੱਲ੍ਹ ਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਅੰਗਰੇਜ਼ ਲੋਕ ਵੀ ਆਪਣੇ ਬੱਚੇ ਨੂੰ ਭੰਗੜਾ ਸਿਖਾਉਣਾ ਚਾਹੁੰਦੇ ਨੇ ਤਾਂ ਕਿ ਉਹ ਪੰਜਾਬੀਆਂ ਦੇ ਬਾਰੇ ਅਤੇ ਦੱਸ ਸਕਣ ਵੀ ਪੰਜਾਬੀਆਂ ਦਾ ਲੋਕ ਨਾਚ ਭੰਗੜਾ ਗਾ ਅਤੇ ਅੱਜ ਕੱਲ੍ਹ ਬਾਹਰੇ ਮੰਨ ਲਉ ਸਾਰੇ ਸਟੇਜਾਂ ਸਟੇਜਾਂ 'ਤੇ ਵੀ ਗਾਇਆ ਜੋ ਕੋਈ ਸਿੰਗਰ ਜਾਂਦਾ ਗਾਇਕ ਜਾਂਦਾ ਤਾਂ ਉਹ ਭੰਗੜੇ ਦੇ ਹੀ ਸ਼ੁਰੂਆਤ 'ਤੇ ਹੀ ਆਪਣਾ ਗਾਣਾ ਸ਼ੁਰੂ ਕਰਦਾ ਗਾ